ਹਾਂਜੀ ਮੈਂ ਸਿੱਖ ਧਰਮ ਨੂੰ ਬਿਲੋਂਗ ਕਰਦੀ ਹਾਂ ਸਿੱਖ ਧਰਮ ਨਾਲ ਸੰਬੰਧ ਰੱਖਦੀ ਹਾਂ ਅਤੇ ਮੇਰਾ ਧਰਮ ਮੈਨੂੰ ਨੂੰ ਸਮਾਜ ਸੇਵਾ ਕਰਨ ਬਾਰੇ ਸਿੱਖਿਆ ਦਿੰਦਾ ਏ ਮੇਰੇ ਧਰਮ ਵਿੱਚ ਅਤੇ ਵੈਸੇ ਵੀ ਲੰਗਰਾਂ ਦੀ ਸੇਵਾ ਗੁਰਦੁਆਰਿਆਂ ਦੀ ਸੇਵਾ ਗਰੀਬ ਦੀ ਸੇਵਾ ਅਪਾਹਜਾਂ ਦੀ ਸੇਵਾ ਸਮਾਜ ਵਿੱਚ ਉਹ ਜਿਹੜੇ ਅਲੱਗ ਕੀਤੇ ਹੁੰਦੇ ਲੋਕ ਨੇ ਸਮਾਜ ਵਿੱਚੋਂ ਉਹ ਨਿਸ਼ਕਾਸ਼ਿਤ ਕੀਤੇ ਹੋਏ ਲੋਕ ਨੇ ਉਹਨਾਂ ਦੀ ਸੇਵਾ ਭਾਵਨਾ ਮੇਰੇ ਇਹ ਸਿੱਖ ਧਰਮ ਨੇ ਮੈਨੂੰ ਬਹੁਤ ਅੱਛੀ ਤਰ੍ਹਾਂ ਸਿਖਾਈ ਹੈ ਅਤੇ ਮੈਂ ਇਹਨਾਂ ਦੀ ਸੇਵਾ ਜੀਅ ਜਾਨ ਨਾਲ ਕਰਦੀ ਹਾਂ ਜਿਵੇਂ ਕਿ ਮੇਰੇ ਧਰਮ ਵਿੱਚ ਕਿਹਾ ਗਿਆ ਹੈ ਕਿ ਗਰੀਬ ਦਾ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਵਿੱਚ ਪੈਸੇ ਪਾਉਣ ਨਾਲੋਂ ਚੰਗਾ ਏ ਕਿ ਮੈਂ ਕਿਸੇ ਗਰੀਬ ਦੀ ਮਦਦ ਕਰ ਸਕਾਂ ਕਿਸੇ ਗਰੀਬ ਦੀ ਸਹਾਇਤਾ ਕਰ ਸਕਾਂ ਤਾਂ ਕਿ ਉਹ ਆਪਣੀ ਦੋ ਟੈਮ ਦੀ ਰੋਟੀ ਹੀ ਵਧੀਆ ਤਰ੍ਹਾਂ ਖਾ ਸਕੇ ਅਤੇ ਆਪਣਾ ਜੀਵਨ ਵਧੀਆ ਤਰ੍ਹਾਂ ਆਪਣੇ ਬੱਚਿਆਂ ਨੂੰ ਫ ਵਧੀਆ ਪੜ੍ਹਾਈ ਲਿਖਾਈ ਦੇ ਕੇ ਉਹਨਾਂ ਦਾ ਜ਼ਿੰਦਗੀ ਸਵਾਰ ਸਕੇ ਅਤੇ ਮੈਂ ਐਵੇਂ ਹੀ ਕਰਦੀ ਹਾਂ ਅਸੀਂ ਆਪਣਾ ਫਰਜ਼ ਪੂਰੀ ਤਰ੍ਹਾਂ ਹੀ ਇਹ ਨਿਭਾਉਂਦੇ ਹਾਂ ਆਪਣੇ ਸਮਾਜ ਸੇਵਾ ਵਿੱਚ ਧੰਨਵਾਦ